ਸਾਡੇ ਪੰਜਾਬ ਰਾਜ ਵਿੱਚ ਮੁੱਖ ਤਿਉਹਾਰ ਦਿਵਾਲੀ ਅਤੇ ਵਿਸਾਖੀ ਹਨ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਦਿਵਾਲੀ ਅਤੇ ਵਿਸਾਖੀ ਦੇ ਨਾਲ ਸਾਡਾ ਇਤਿਹਾਸ ਜੁੜਿਆ ਹੋਇਆ ਸਾਡੀਆਂ ਜੜ੍ਹਾਂ ਜੁੜੀਆਂ ਹਨ ਜੋ ਕਿ ਸਾਨੂੰ ਦੱਸਦੀਆਂ ਹਨ ਕਿਉਂਕਿ ਦਿਵਾਲੀ ਵਾਲੇ ਦਿਨ ਸਾਡੇ ਛੇਵੇਂ ਪਾਤਸ਼ਾਹ ਆਪਣੇ ਬ ਬਵੰਜਾ ਰਾਜਿਆਂ ਨੂੰ ਲੈ ਕੇ ਗਵਾਲੀਅਰ ਦੇ ਕਿਲੇ ਵਿੱਚੋਂ ਅੰਮ੍ਰਿਤਸਰ ਸਾਹਿਬ ਆਏ ਸਨ ਅਤੇ ਉੱਥੇ ਦੀਵੇ ਬਾਲ ਕੇ ਜਿੰਨੀ ਵੀ ਸੰਗਤ ਨੇ ਉਹਨਾਂ ਨੇ ਉਹਨਾਂ ਦਾ ਸਵਾਗਤ ਕੀਤਾ ਸੀ ਅਤੇ ਉਹਨਾਂ ਦੀ ਜਸ਼ਨ ਮਨਾਇਆ ਗਿਆ ਸੀ ਉਦੋਂ ਆਜ਼ਾਦੀ ਦੇ ਵਿੱਚ ਅਤੇ ਅੱਗੇ ਜਿਹੜਾ ਵਿਸਾਖੀ ਤਿਉਹਾਰ ਹੈ ਇਹ ਤਾਂ ਸਾਡਾ ਮੁੱਢ ਹੈ ਕਿਉਂਕਿ ਇਸ ਨੇ ਸਿੱਖ ਸਿੱਖਾਂ ਨੂੰ ਜਨਮ ਦਿੱਤਾ ਹੈ ਇਸ ਦੇ ਰਾਹੀਂ ਸਿੱਖ ਅੰਮ੍ਰਿਤਪਾਨ ਕਰਕੇ ਸਿੰਘ ਸਜੇ ਸਨ ਕਿਉਂਕਿ ਵਿਸਾਖੀ ਮੁੱਖ ਤਿਉਹਾਰ ਹੈ ਇਹ ਬਿਨਾਂ ਕਿਸੇ ਭੇਦਭਾਵ ਤੋਂ ਮਨਾਏ ਜਾਂਦੇ ਹਨ ਇੱਥੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ ਕਿ ਤੂੰ ਕਿਹੜੇ ਧਰਮ ਦਾ ਜਾਂ ਉਹ ਕਿਹੜੇ ਧਰਮ ਦਾ ਸਭ ਧਰਮਾਂ ਨੂੰ ਬਰਾਬਰ ਸਨਮਾਨ ਦਿੱਤਾ ਜਾਂਦਾ ਹੈ ਜਿਹੜੇ ਕ੍ਰਿਸ਼ਮਸ ਮਨਾਉਂਦੇ ਹਨ ਉਹਨਾਂ ਵੀ ਕ ਸਰਦੀਆਂ ਦੇ ਦਿਨਾਂ ਵਿੱਚ ਕਈ ਲੋਕ ਕ੍ਰਿਸਮਿਸ ਮਨਾਉਂਦੇ ਹਨ ਉਹਨਾਂ ਦਾ ਆਦਰ ਕਰਦੇ ਹਨ ਪਰ ਸਾਡੇ ਪੰਜਾਬ ਦੇ ਵਿੱਚ ਕ੍ਰਿਸਮਸ ਨਹੀਂ ਮਨਾਈ ਜਾਂਦੀ ਸਾਡੇ ਪੰਜਾਬ ਦੇ ਵਿੱਚ ਸ਼ਹੀਦੀ ਜੋੜ ਮੇਲੇ ਮਨਾਏ ਜਾਂਦੇ ਹਨ ਕਿਉਂਕਿ ਇਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਵਿਛੜਿਆ ਸੀ ਅਤੇ ਉਹ ਇਕੱਠੇ ਅਲੱਗ ਅਲੱਗ ਹੋ ਗਏ ਸੀ ਸਨ ਅਤੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਸਨ ਇਸ ਦੇ ਵਿੱਚ ਇਸ ਦੇ ਦੌਰਾਨ ਚਮਕੌਰ ਦੀ ਜੰਗ ਵੀ ਹੋਈ ਸੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਛੋਟੇ ਸਾਹਿਬਜ਼ਾਦੇ ਸ਼ਹੀਦ ਵੀ ਹੋਏ ਸਨ